ਹੈਲੋ ਵੀਰੇ ਓਲਾ ਕੋਪਨੀ ਤੋਂ ਗੱਲ ਕਰ ਰਹੇ ਹੋ ਹਾਂਜੀ ਜੀ ਮੈਂ ਆਪਣੇ ਬਠਿੰਡਾ ਤੋਂ ਕੈਬ ਬੁੱਕ ਕੀਤੀ ਸੀ ਮੈਂ ਚੰਡੀਗੜ੍ਹ ਤੀਕਰ ਜਾਣਾ ਸੀ ਮੈਂ ਆਪਣੇ ਜਿਹੜੇ ਪੁਆਇੰਟ ਚੰਡੀਗੜ੍ਹ ਪਹੁੰਚ ਚੁੱਕੀ ਹਾਂ ਹੁਣ ਮੇਰੇ ਨਾ ਇੱਕ ਛੋਟੀ ਜਿਹੀ ਪ੍ਰੋਬਲਮ ਆ ਰਹੀ ਆ ਵੀ ਜਿਹੜੀ ਕੈਬ ਬੁੱਕ ਕਰਨ ਵਾਸਤੇ ਜਿਹੜੀ ਹੈਗੀ ਆ ਔਨਲਾਈਨ ਪੇਮੈਂਟ ਕਰਨੀ ਪੈਣੀ ਸੀਗੀ ਮੇਰੇ ਕੋਲ ਜਿਹੜੀ ਹੈਗੀ ਆ ਔਨਲਾਈਨ ਪੇਮੈਂਟ ਕਰਨ ਦਾ ਕੋਈ ਵੀ ਮੋਡ ਨਹੀਂ ਹੈਗਾ ਨਾ ਗੂਗਲ ਪੇਅ ਜਾਂ ਪੇਟੀਐਮ ਵਗੈਰਾ ਕੁਛ ਵੀ ਹੈ ਨਹੀਂ ਪਲੀਜ਼ ਤੁਸੀਂ ਕੈਸ਼ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਸ ਤਰ੍ਹਾਂ ਕਰੋ ਵੀ ਮੈਂ ਤੁਹਾਨੂੰ ਕੈਸ਼ ਦੇ ਦਿੰਦੀ ਹੈਗੀ ਹਾਂ ਤੁਸੀਂ ਆਪਣੇ ਤੋਂ ਜਿਹੜੀ ਹੈਗੀ ਆ ਗੂਗਲ ਪੇਮੈਂਟ ਜਾਂ ਵੀ ਦੂਜੀ ਔਨਲਾਈਨ ਪੇਮੈਂਟ ਆ ਜਿਹੜੀ ਕਰ ਦਿਉ ਪਲੀਜ਼ ਇਸ ਤਰ੍ਹਾਂ ਕਰ ਸਕਦੇ ਹੋ